ਸਤਿ ਸ਼੍ਰੀ ਅਕਾਲ ਮੈਂ ਪਠਾਨਕੋਟ ਤੋਂ ਛੋਟੇ ਜਿਹੇ ਪਿੰਡ ਭੁੱਜ ਦਾ ਰਹਿਣ ਵਾਲਾ ਹਾਂ ਵਿਦਿਆਰਥੀ ਹਾਂ ਅਤੇ ਜੋ ਕਿ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡੇ ਜਿਹੜੀ ਸਰਕਾਰ ਹੈਗੀ ਆ ਇਹਨਾਂ ਨੇ ਜਿਹੜੇ ਸਾਡੇ ਪਿੰਡ ਵਿੱਚ ਜਿਹੜੇ ਪਾਰਕ ਹੈਗੇ ਆ ਇਹ ਖੁਲ ਤਿੰਨ ਚਾਰ ਦੋ ਤਿੰਨ ਪਾਰਕ ਖੋਲ੍ਹੇ ਹੈਗੇ ਆ ਅਤੇ ਜੋ ਜਿਹਦੇ ਵਿੱਚ ਜਿਹੜੇ ਸ਼ਾਮ ਨੂੰ ਜਿਹੜੇ ਬੱਚੇ ਹੈਗੇ ਆ ਉਹ ਖੇਲਦੇ ਹੈਗੇ ਜੋ ਖੇਲਦੇ ਹੋਏ ਬੜੇ ਪਿਆਰੇ ਲੱਗਦੇ ਹੈਗੇ ਆ ਅਤੇ ਕੁਝ ਜਿਹੜੀ ਮਹਿਲਾਵਾਂ ਅਤੇ ਵਿਅਕਤੀ ਹੈਗੇ ਆ ਇਹ ਸੈਰ ਸਪਾਟਾ ਕਰਦੇ ਹੈਗੇ ਆ ਅਤੇ ਜਿਹੜੀ ਸਾਡੀ ਸਰਕਾਰ ਹੈਗੀ ਆ ਇਹਨਾਂ ਨੇ ਬੜੀਆਂ ਹੀ ਮੁਹਿੰਮਾਂ ਚਲਾਈਆਂ ਹੀ ਚਲਾਏ ਦੀਆਂ ਹੈਗੀਆਂ ਅਤੇ ਇਹਨਾਂ ਨੇ ਕਈਆਂ ਪੰਜ ਛੇ ਬੱਸਾਂ ਵਿੱਚ ਲਈ ਹੈਗੀ ਕਿ ਉਹਦਾ ਬੜਾ ਹੀ ਘੱਟ ਕਿਰਾਇਆ ਹੈਗਾ ਕਿ ਤੁਸੀਂ ਵੱਡੀ ਜਾ ਲੰਬੀ ਤੋਂ ਲੰਬੀ ਯਾਤਰਾ ਤੁਸੀਂ ਕਰ ਸਕਦੇ ਹੋ ਅਤੇ ਉਹਦੀ ਵੀ ਜਿਹੜਾ ਕਿਰਾਇਆ ਹੋਏਗਾ ਉਹ ਘੱਟ ਹੋਏਗਾ ਅਤੇ ਉਹ ਲੋਕ ਹੁਣ ਜਿਹੜੀ ਹੈਗੀ ਆ ਉਹ ਯਾਤਰਾਵਾਂ ਕਰਦੇ ਹੈਗੇ ਆ ਆਪਣਾ ਮਨੋਰੰਜਨ ਵੀ ਕਰਦੇ ਹੈਗੇ ਜਿਸ ਕਰਕੇ ਕਿ ਉਹ ਲੋਕ ਬੜੇ ਹੀ ਖੁਸ਼ ਹੈਗੇ ਕਿ ਘੱਟ ਤੋਂ ਘੱਟ ਕਿਰਾਏ 'ਤੇ ਜਿਹੜੇ ਛੁੱਟੀਆਂ ਨੂੰ ਜਿਹੜੇ ਨਿਆਣੇ ਹੁੰਦੇ ਆ ਉਹ ਅਲੱਗ ਅਲੱਗ ਜਗ੍ਹਾ 'ਤੇ ਥਾਵਾਂ 'ਤੇ ਘੁੰਮ ਕੇ ਆ ਸਕਦੇ ਆ ਅਤੇ ਜਿਹੜੀ ਇਹ ਸਰਕਾਰ ਹੈਗੀ ਆ ਇਹ ਬੜੀ ਹੀ